ਸਾਡੀ ਰਸੋਈ ਵਿੱਚ ਬਿਜਲੀ ਦੇ ਵੱਖ ਵੱਖ ਤਰ੍ਹਾਂ ਦੇ ਉਪਕਰਨ ਹੈਗੇ ਹੈ ਜਿਵੇਂ ਕਿ ਓਵਨ ਹੈਂਡ ਬਲੈਂਡਰ ਹੋ ਗਿਆ ਮਿਕਸਰ ਗਰੈਂਡਰ ਹੋਇਆ ਇੰਡਕਸ਼ਨ ਹੋ ਗਿਆ ਗੈਸ ਸਲੰਡਰ ਹੋ ਗਿਆ ਫਿਲਟਰ ਹੋ ਗਿਆ ਅਤੇ ਫਰਿਜ ਹੋ ਗਈ ਅਤੇ ਜਿਵੇਂ ਕਿ ਪੁਰਾਣੇ ਦਿਨਾਂ 'ਚ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਉਹਨਾਂ ਦਿਨਾਂ ਨਾਲੋਂ ਹੁਣ ਦਾ ਤਜਰਬਾ ਵੀ ਹੈਗਾ ਹੁਣ ਟੈਕਨੋਲਜੀ ਜਿਵੇਂ ਵੱਧ ਗਈ ਹੈ ਜਿਵੇਂ ਹੁਣ ਪਹਿਲਾਂ ਫਰਿਜ ਨਹੀਂ ਹੁੰਦਾ ਸੀਗਾ ਤਾਂ ਲੋਕ ਘੜਿਆਂ 'ਚ ਪਾਣੀ ਰੱਖਦੇ ਸੀਗੇ ਕੋਰੇ ਘੜੇ ਦੇ ਵਿੱਚ ਉੱਪਰ ਗਿੱਲੀ ਕਰਕੇ ਬੋਰੀ ਦੇ ਦੇਣੀ ਪਾਣੀ ਪਾਉਣਾ ਉਹਦੇ ਨਾਲ ਪਾਣੀ ਠੰਡਾ ਹੋ ਜਾਣਾ ਜਿੱਦਾਂ ਅਤੇ ਜਿਵੇਂ ਫਿਲਟਰ ਹੋ ਗਿਆ ਫਿਲਟਰ ਉਦੋਂ ਲੋਕ ਵਰਤਦੇ ਨਹੀਂ ਸੀ ਇਕੱਲੇ ਖੂਹਾਂ ਦਾ ਪਾਣੀ ਪੀਂਦੇ ਸੀਗੇ ਘੜੇ ਦੇ ਵਿੱਚ ਪਾਣੀ ਪਾ ਕੇ ਜਾਂ ਫਿਰ ਫਿ ਅ ਫਟਕੜੀ ਪਾ ਦੇਣੀ ਪਾਣੀ ਦੇ ਵਿੱਚ ਉਹਦੇ ਨਾਲ ਪਾਣੀ ਫਿਲਟਰ ਕਰ ਲੈਂਦੇ ਇੱਦਾਂ ਵਰਤਦੇ ਸੀਗੇ ਜਿਵੇਂ ਹੈਂਡ ਬਲੈਂਡਰ ਜਾਂ ਮਿਕਸਰ ਗਰੈਂਡਰ ਹੋ ਗਿਆ ਇਹ ਚੀਜ਼ਾਂ ਨਹੀਂ ਵਰਤਦੇ ਸੀ ਉਦੋਂ ਕੁੰਡਾ ਘੋਟਣਾ ਵਰਤਦੇ ਸੀ ਜਾਂ ਮਾਮ ਜਿਸਤਾ ਵਰਤਦੇ ਸੀ ਮਾਮ ਜਿਸਤਾ ਲੋਹੇ ਦਾ ਹੁੰਦਾ ਕੁੰਡਾ ਘੋਟਣਾ ਮਿੱਟੀ ਦਾ ਜਿਵੇਂ ਕੁੰਡਾ ਹੋਇਆ ਘੋਟਣਾ ਲੱਕੜ ਦਾ ਨਿੰਮ ਦਾ ਹੋ ਗਿਆ ਇੱਦਾਂ ਦੀਆਂ ਚੀਜ਼ਾਂ ਵਰਤਦੇ ਸੀ ਓਵਨ ਤਾਂ ਹੁੰਦਾ ਹੀ ਨਹੀਂ ਸੀ ਗੈਸ ਸਲਿੰਡਰ ਦ ਜਿਵੇਂ ਹੁਣ ਗੈਸ ਸਲੰਡਰ ਦੀ ਵਰਤੋਂ ਹੋਣ ਲੱਗ ਗਈ ਉਦੋਂ ਲੋਕ ਚੁੱਲ੍ਹਾ ਵਰਤਦੇ ਸੀ ਸੁਬਹ ਦਾ ਕੰਮ ਵੀ ਜਿਵੇਂ ਚੁੱਲ੍ਹੇ ਦੇ ਵਿੱਚ ਪਾਥੀਆਂ ਹੋ ਛਿਟੀਆਂ ਬਾਲਣੀਆਂ ਲੱਕੜਾਂ ਬਾਲਣੀਆਂ ਇੱਦਾਂ ਦਾ ਕੰਮ ਕਰਦੇ ਹੁੰਦੇ ਸੀ ਹੁਣ ਗੈਸ ਸਲਿੰਡਰ ਦੇ ਨਾਲ ਲੋ ਵੀ ਬਹੁਤ ਵਧੀਆ ਹੋ ਚੱਲਿਆ ਅਤੇ ਨਾਲ ਹੀ ਜਿਵੇਂ ਦੁੱਧ ਗਰਮ ਕਰਨਾ ਪਹਿਲਾਂ ਲੋਕ ਹਾਰੇ ਵਰਤਦੇ ਸੀਗੇ ਹਾਰੇ ਦੇ ਵਿੱਚ ਪਾਥੀਆਂ ਦੇ ਨਾਲ ਅੱਗ ਜਲਾਉਣੀ ਉਹਨਾਂ ਨੇ ਵਿੱਚ ਅੱਗ ਪਾ ਦੇਣੀ ਅਤੇ ਹ ਚਾਟੀ ਦੇ ਵਿੱਚ ਕਾੜ੍ਹਨੀ ਦੇ ਵਿੱਚ ਮਤਲਬ ਦੁੱਧ ਪਾਉਣਾ ਉਹਨਾਂ ਨੇ ਕਾੜ੍ਹਨੀ ਦੇ ਵਿੱਚ ਦੁੱਧ ਗਰਮ ਕਰਕੇ ਰੱਖਣਾ ਹੁਣ ਇਹ ਚੀਜ਼ਾਂ ਖਤਮ ਹੋ ਗਈਆਂ